ਮੈਨੂੰ ਬਚਪਨ ਤੋਂ ਹੀ ਯਾਤਰਾ ਕਰਨ ਦਾ ਬਹੁਤ ਸ਼ੌਕ ਹੈ ਅਸੀਂ ਆਮ ਤੌਰ 'ਤੇ ਜਦੋਂ ਯਾਤਰਾ ਕਰਦੇ ਹਨ ਜਾਂ ਤਾਂ ਬੱਸ ਰਾਹੀਂ ਕਰਦੇ ਹਾਂ ਜਾਂ ਫਿਰ ਰੇਲ ਗੱਡੀ ਰਾਹੀਂ ਅਤੇ ਜਿਹੜੀ ਭਾਰਤੀ ਆਵਾਜਾਈ ਪ੍ਰਣਾਲੀ ਹੈ ਉਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ਼ ਹੁਣ ਖ਼ਰਾਬ ਹੋ ਚੁੱਕੀ ਹੈ ਕਿਉਂਕਿ ਇੱਕ ਜਿਹੜੀ ਭਾਰਤੀ ਆਵਾਜਾਈ ਪ੍ਰਣਾਲੀ ਉਹ ਹੈ ਤਾਂ ਸਾਡੇ ਲਈ ਵਰਦਾਨ ਪਰ ਅਸੀਂ ਉਹਨੂੰ ਸਰਾਪ ਬਣਾ ਚੁੱਕੇ ਹਾਂ ਕਿਉਂਕਿ ਲੋਕ ਜਦੋਂ ਆਮ ਤੌਰ 'ਤੇ ਦੇਸ਼ ਵਿੱਚ ਘੁੰਮਦੇ ਹਨ ਤਾਂ ਉਹ ਮੋਟਰਸਾਈਕਲ ਸਕੂਟਰ ਕਾਰ ਬੱਸ ਰੇਲ ਗੱਡੀ ਜਾਂ ਫਿਰ ਹਵਾਈ ਜਹਾਜ਼ ਦੇ ਰਾਹੀਂ ਆਪਣਾ ਜਾਂ ਆਪਣੀ ਯਾਤਰਾ ਕਰਦੇ ਹਨ ਪਰ ਦੇੇਖਣ 'ਚ ਆਉਂਦਾ ਹੈ ਕਿ ਲੋਕਾਂ ਨੇ ਆਵਾਜਾਈ ਪ੍ਰਣਾਲੀ ਆਪਣੇ ਹੱਥ ਵਿੱਚ ਲੈ ਲਈ ਹੈ ਕਿਉਂਕਿ ਕੋਈ ਵੀ ਆਵਾਜਾਈ ਦੇ ਨਿਯਮਾਂ ਨੂੰ ਪਾਲਣਾ ਨਹੀਂ ਕਰਦਾ ਉਹਨਾਂ ਦੀ ਸਾਰੇ ਉਲੰਘਣਾ ਕਰਦੇ ਹਨ ਇੱਦਾਂ ਆਪਣੇ ਬਾ ਕਾਰਾਂ ਮੋਟਰਸਾਈਕਲ ਸਕੂਟਰ ਸੜਕਾਂ 'ਤੇ ਦੌੜਾਉਂਦੇ ਹਨ ਕਿ ਜਿਹੜਾ ਪੈਦਲ ਜਾ ਰਿਹਾ ਬੰਦਾ ਉਹਨੂੰ ਤਾਂ ਦੇਖਦੇ ਹੀ ਨਹੀਂ ਉਹਦੇ ਵੱਲ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ ਅਤੇ ਯਾਤਰਾ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਜਦੋਂ ਤੁਸੀਂ ਕਦੇ ਬੱਸ ਦੀ ਬੱਸ 'ਚ ਯਾਤਰਾ ਕਰਦੇ ਹੋ ਤਾਂ ਪਹਿਲਾਂ ਤਾਂ ਕਈ ਵਾਰ ਸਾਨੂੰ ਘੰਟਾ ਘੰਟਾ ਖੜ੍ਹਕੇ ਬੱਸ ਹੀ ਨਹੀਂ ਮਿਲਦੀ ਅਗਰ ਮਿਲਦੀ ਹੈ ਤਾਂ ਉਹਦੇ 'ਚ ਸੀਟਾਂ ਨਹੀਂ ਹੁੰਦੀਆਂ ਅਗਰ ਸੀਟ ਹੁੰਦੀ ਹੈ ਤਾਂ ਬੱਸ ਐਨੀ ਜ਼ਿਆਦਾ ਗੰਦੀ ਹੁੰਦੀ ਅੰਦਰੋਂ ਕਿ ਬੈਠਣ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਸਫ਼ਰ ਦੂਰ ਦਾ ਕਰਨਾ ਹੁੰਦਾ ਹੈ ਫਿਰ ਜਾਣਾ ਤਾਂ ਪੈਂਦਾ ਹੀ ਹੈ ਕਿਸੇ ਤਰ੍ਹਾਂ ਵੀ ਕਰਕੇ ਪਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਅਸੀਂ ਰੇਲ ਗੱਡੀ 'ਚ ਜਾਈਏ ਤਾਂ ਕਈ ਵਾਰ ਰੇਲ ਗੱਡੀ ਟਾਈਮ ਸਿਰ ਨਹੀਂ ਆਉਂਦੀ ਜਾਂ ਫਿਰ ਉਹ ਮੌਸਮ ਦੇ ਕਾਰਨ ਹੋ ਸਕਦੀ ਹੈ ਜਾਂ ਫਿਰ ਪਿੱਛੋ ਹੀ ਕਈ ਵਾਰ ਮਾਲ ਗੱਡੀ ਅੱਗੇ ਆ ਜਾਂਦੀ ਤਾਂ ਫਿਰ ਰੇਲ ਗੱਡੀ ਰੁਕ ਜਾਂਦੀ ਹੈ ਤਾਂ ਫਿਰ ਉਹਦੇ 'ਚ ਵੀ ਅਗਰ ਤਾਂ ਏ ਸੀ ਸੀਟ ਏ ਸੀ ਡੱਬਾ ਲੈ ਲਉ ਤਾਂ ਵਧੀਆ ਹੈ ਅਤੇ ਜਰਨਲ 'ਚ ਲੈ ਲਉ ਤਾਂ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਤਾਂ ਉਹਦੇ ਵਿੱਚ ਕੋਈ ਵੋਸ਼ਰੂਮ ਹੁੰਦਾ ਅਤੇ ਨਾ ਹੀ ਕੋਈ ਟੋਏਲਿਟ ਹੁੰਦੀ ਹੈ ਅਤੇ ਇਹਨਾਂ ਨੂੰ ਅਸੀਂ ਸੁਧਾਰ ਸਕਦੇ ਹਾਂ ਇਹਨਾਂ ਨੂੰ ਸੁਧਾਰਿਆਂ ਇੱਦਾਂ ਜਾ ਸਕਦਾ ਹੈ ਕਿ ਜਾਂ ਪਹਿਲਾਂ ਤਾਂ ਜਿਹੜੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੈ ਉਹਨਾਂ ਨੂੰ ਸਖ਼਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਅਤੇ ਦੂਜਾ ਜਿਹੜੀ ਆਵਾਜਾਈ ਦੇ ਸਾਧਨਾਂ 'ਚ ਦਿੱਕਤ ਆਉਂਦੀ ਹੈ ਬੱਸ ਦੀ ਬੱਸ ਬੱਸਾਂ ਦੀ ਦਿੱਕਤ ਆਉਂਦੀ ਹੈ ਜੇ ਰੇਲ ਗੱਡੀਆਂ ਦਿੱਕਤ ਆਉਂਦੀ ਹੈ ਤਾਂ ਸਾਨੂੰ ਉਹ ਜ਼ਿਆਦਾ ਤੋਂ ਜ਼ਿਆਦਾ ਬੱਸਾਂ ਜਿਹੜੀਆਂ ਉਹ ਜਿਹੜੀਆਂ ਆਂ ਆਮ ਜਨਤਾ ਹੈ ਉਹਦੇ ਲਈ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਕਿਉਂਕਿ ਸਮੇਂ ਸਮੇਂ 'ਤੇ ਜੇ ਸਿਰ 'ਤੇ ਬੱਸ ਆਵੇ ਤਾਂ ਫਿਰ ਯਾਤਰਾ ਕਰਨ ਵਿੱਚ ਵੀ ਮੁਸ਼ਕਲ ਨਹੀਂ ਆਉਂਦੀ ਅਤੇ ਦੂਜਾ ਜਦੋਂ ਯਾਤਰਾ ਕਰਦੇ ਹਾਂ ਤਾਂ ਜਿਹੜੇ ਕੰਡਕਟਰਾਂ ਦਾ ਬਿਹੇਵ ਦਾ ਵਿਵਹਾਰ ਹੈ ਉਹਨੂੰ ਵੀ ਥੋੜ੍ਹਾ ਜਿਹਾ ਕੁ ਦੇਖਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਉਹਦੇ 'ਤੇ ਵੀ ਉਹ ਵੀ ਬਹੁਤ ਤਰ੍ਹਾਂ ਦਾ ਰੂਡ ਬਿਹੇਵ ਕਰਦੇ ਨੇ ਸਿਆਣਿਆਂ ਨਾਲ਼ ਵੀ ਅਤੇ ਬੱਚਿਆਂ ਨਾਲ਼ ਵੀ